ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਇਹਨਾਂ ਵਿੱਚ ਪ੍ਰਮੁੱਖ ਖੇਡਾਂ ਕ੍ਰਿਕਟ ਫੁੱਟਬਾਲ ਅਤੇ ਬ ਟੈਨਿਸ ਬੈਡਮਿੰਟਨ ਹੈ ਆ ਲੋਕ ਇਹਨਾਂ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਖੇਡਦੇ ਅਤੇ ਦੇਖਣਾ ਪਸੰਦ ਕਰਦੇ ਹਨ ਜੇ ਅਸੀਂ ਪੰਜਾਬ ਵਿੱਚ ਕ੍ਰਿਕਟ ਦੀ ਗੱਲ ਕਰੀਏ ਤਾਂ ਲੋਕ ਇਸ ਨੂੰ ਖੇਡਣਾ ਅਤੇ ਦੇਖਣਾ ਬਹੁਤ ਪਸੰਦ ਕਰਦੇ ਹਨ ਜਦੋਂ ਵੀ ਕ੍ਰਿਕਟ ਦਾ ਮੈਚ ਹੁੰਦਾ ਹੈ ਲੋਕ ਬਹੁਤ ਹੀ ਭਾਰੀ ਸੰਖਿਆ ਦੇ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਖੇਡ ਦਾ ਬਹੁਤ ਹੀ ਆਨੰਦ ਲੈਂਦੇ ਹਨ ਅਤੇ ਉਨਾਂ ਨੂੰ ਬਹੁਤ ਹੀ ਉਹਦੇ ਨਾਲ ਉਹਨਾਂ ਦਾ ਦਿਲ ਅਟੈਚ ਹੋਇਆ ਹੁੰਦਾ ਹੈਗਾ ਜਦੋਂ ਵੀ ਕੋਈ ਵੀ ਕ੍ਰਿਕਟ ਵਾਲਾ ਚੌਕਾ ਜਾਂ ਛਿੱਕਾ ਲਾਉਂਦਾ ਹੈਗਾ ਆ ਉਹਨਾਂ ਦੇ ਚੌਕੇ ਅਤੇ ਛਿੱਕੇ ਲਾਉਣ 'ਤੇ ਲੋਕ ਬਹੁਤ ਖੁਸ਼ ਹੁੰਦੇ ਹਨ ਜਦੋਂ ਵੀ ਇੰਡੀਆ ਜਿੱਤਦੀ ਹੈਗੀ ਹੈ ਤਾਂ ਇੰਡੀਆ ਦੇ ਜਿੰਨੇ ਵੀ ਸਾਰੇ ਲੋਕ ਹਨ ਉਹ ਆਪਣੇ ਘਰਾਂ ਦੇ ਵਿੱਚ ਇਸ ਦੀ ਖੁਸ਼ੀ ਮਨਾਉਂਦੇ ਹਨ ਇਸ ਤਰ੍ਹਾਂ ਹੀ ਫੁੱਟਬੋਲ ਅਤੇ ਟੈਨਿਸ ਬੈਡਮਿੰਟਨ ਦੇ ਮੈਚ ਵੀ ਵਿੱਚ ਵੀ ਜਦੋਂ ਇੰਡੀਆ ਜਿੱਤਦੀ ਹੈ ਤਾਂ ਇੰਡੀਆ ਦੇ ਲੋਕ ਬਹੁਤ ਹੀ ਖੁਸ਼ ਹੋ ਜਾਂਦੇ ਹਨ ਅਤੇ ਸਾਰੇ ਹੀ ਦਿਵਾਲੀ ਦੀ ਤਰ੍ਹਾਂ ਇਸ ਤਿਉਹਾਰ ਨੂੰ ਮਨਾਉਂਦੇ ਹਨ ਇਸ ਤਰ੍ਹਾਂ ਹੀ ਫੁਟਬੋਲ ਕ੍ਰਿਕਟ ਬੈਡਮਿੰਟਨ ਅਤੇ ਖੇਡਾਂ ਜਿੰਨੀਆਂ ਵੀ ਹਨ ਇਹ ਸਾਰੀਆਂ ਪ੍ਰਮੁੱਖ ਖੇਡਾਂ ਹਨ ਜਿਹੜੀਆਂ ਕਿ ਪੰਜਾਬ ਵਿੱਚ ਖੇਡੀਆਂ ਜਾਂਦੀਆਂ ਹਨ ਅਤੇ ਲੋਕ ਇਹਨਾਂ ਨੂੰ ਦੇਖਣਾ ਅਤੇ ਖੇਡਣਾ ਬਹੁਤ ਹੀ ਪਸੰਦ ਕਰਦੇ ਹਨ ਅਤੇ ਇਹਨਾਂ ਵਿੱਚ ਜਿੰਨੇ ਵੀ ਖਿਡਾਰੀ ਖੇਡਦੇ ਹਨ ਲੋਕ ਉਹਨਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਦੇਖਦੇ ਅਤੇ ਉਹਨਾਂ ਦੇ ਨਾਲ ਫੋਟੋਆਂ ਕਰਵਾਉਣ ਦੇ ਲਈ ਭੱਜੇ ਜਾਂਦੇ ਹਨ